ਉੱਨੀ ਅਗਸਤ ਉੱਨੀ ਸੌ ਚੁਰਾਨਵੇਂ ਦਸ ਸਤੰਬਰ ਉੱਨੀ ਸੌ ਪਚਾਨਵੇਂ ਅੱਠ ਅਪ੍ਰੈਲ ਦੋ ਹਜ਼ਾਰ ਅਠਾਰਾਂ ਗਿਆਰਾ ਮਾਰਚ ਦੋ ਹਜ਼ਾਰ ਉੱਨੀ ਇੱਕ ਮਈ ਦੋ ਹਜ਼ਾਰ ਚੌਵੀ